ਸਾਡੇ ਖੇਤਰ ਵਿੱਚ ਬਹੁਤ ਸਾਰੇ ਲੋਕ ਸਿਲਾਈ ਕਢਾਈ ਜਾਂ ਬੁਣਾਈ ਕਰਦੇ ਹਨ ਉਹ ਬਹੁਤ ਸੋਹਣੇ ਤਰੀਕੇ ਨਾਲ ਸਿਲਾਈ ਕਢਾਈ ਜਾਂ ਬੁਣਾਈ ਕਰਦੇ ਹਨ ਲੋਕ ਪੈਟ ਅਲੱਗ ਅਲੱਗ ਪੈਟਰਨ ਜਾਂ ਅਲੱਗ ਅਲੱਗ ਡਿਜ਼ਾਇਨ ਦੇ ਸੂਟਾਂ ਉੱਤੇ ਕਢਾਈ ਕੱਢਦੇ ਹਨ ਉਹ ਹਰੇਕ ਕਿਸਮ ਦੀ ਕਢਾਈ ਕੱਢਦੇ ਹਨ ਸਾਡੇ ਖੇਤਰ ਵਿੱਚ ਪੁਰਾਣੇ ਤਰੀਕੇ ਨਾਲ ਹੀ ਕਢਾਈ ਕੀਤੀ ਜਾਂਦੀ ਹੈ ਕੁਝ ਸਮੇਂ ਪਹਿਲਾਂ ਮੈਂ ਵੀ ਕਢਾਈ ਕੱਢਣ ਦੀ ਕੋਸ਼ਿਸ਼ ਕੀਤੀ ਸੀ ਫੁਲਕਾਰੀ 'ਤੇ ਮੇਰੀ ਮੰਮੀ ਜੀ ਅਤੇ ਮੇਰੀ ਨਾਨੀ ਜੀ ਵੀ ਫੁਲਕਾਰੀ 'ਤੇ ਬਹੁਤ ਸੋਹਣੀ ਕਢਾਈ ਕੱਢ ਲੈਂਦੇ ਹਨ ਅਤੇ ਮੈਂ ਉਹਨਾਂ ਤੋਂ ਸਿੱਖਿਆ ਕਿ ਕਿਵੇਂ ਫੁਲਕਾਰੀ 'ਤੇ ਕਢਾਈ ਕੱਢਣੀ ਹੈ ਉਨ੍ਹਾਂ ਨੇ ਮੈਨੂੰ ਬਹੁਤ ਸੋਹਣੇ ਤਰੀਕੇ ਨਾਲ ਸਿਖਾਇਆ ਕਿ ਇਸ ਤਰ੍ਹਾਂ ਇਹ ਕਢਾਈ ਹੁੰਦੀ ਹੈ ਅਤੇ ਮੈਂ ਕਢਾਈ ਕੱਢੀ ਫੁਲਕਾਰੀ 'ਤੇ ਪਹਿਲੀ ਵਾਰ ਤਾਂ ਮੇਥੋਂ ਇੰਨੀ ਸੋਹਣੀ ਨਹੀਂ ਨਿਕਲੀ ਅਤੇ ਮੈਂ ਵਾਰ ਵਾਰ ਕੋਸ਼ਿਸ਼ ਕੀਤੀ ਕਰੀ ਅਤੇ ਅਖੀਰ 'ਤੇ ਮੇਥੋਂ ਇਹ ਕਢਾਈ ਬਹੁਤ ਸੋਹਣੀ ਨਿਕਲੀ ਅਤੇ ਮੈਂ ਬਹੁਤ ਸੋਹਣੇ ਢੰਗ ਨਾਲ ਇਹ ਕਢਾਈ ਕੱਢ ਲਈ ਮੇਰਾ ਫੁਲਕਾਰੀ 'ਤੇ ਬਹੁਤ ਸੋਹਣੀ ਕਢਾਈ ਜਿਹੜੀ ਹੈ ਉਹ ਨਿਕਲੀ ਮੈਂ ਅਲੱਗ ਅਲੱਗ ਰੰਗਾਂ ਨਾਲ ਇਹ ਕਢਾਈ ਕੱਢੀ ਸੀ ਅਤੇ ਫੁਲਕਾਰੀ 'ਤੇ ਕਢਾਈ ਕੱਢੀ ਮੈਂ ਆਪਣੀ ਨਾਨੀ ਅਤੇ ਮੰਮੀ ਤੋਂ ਸਿੱਖੀ ਅਤੇ ਬਹੁਤ ਸੋਹਣੀ ਕੱਢ ਲੈਂਦੇ ਹਨ ਅਤੇ ਸਾਡੇ ਖੇਤਰ ਵਿੱਚ ਤਾਂ ਕਢਾਈ ਸਿਲਾਈ ਤਾਂ ਬਹੁਤ ਹੀ ਜ਼ਿਆਦਾ ਕੰਮ ਹੁੰਦਾ ਹੈ ਅਸਲ ਵਿੱਚ ਮੇਰੀ ਨਾਨੀ ਜੀ ਖੁਦ ਇੱਕ ਟੇਲਰ ਹਨ ਅਤੇ ਮੇਰੀ ਮੰਮੀ ਜੀ ਉਹਨਾਂ ਦਾ ਹੱਥ ਵੰਡਾਉਂਦੇ ਹਨ ਅਤੇ ਸਾਡੇ ਖੇਤਰ ਵਿੱਚ ਸਿਲਾਈ ਕਢਾਈ ਦਾ ਬਹੁਤ ਕੰਮ ਹੈ